ਕਿੱਤੇ ਵਜੋਂ ਦੇਖਿਆ ਜਾਵੇ ਤਾਂ ਮੈਂ ਇੱਕ ਗਾਇਕ ਹੀ ਹਾਂ ਮੇਰਾ ਪੂਰਾ ਦਿਨ ਸੰਗੀਤ ਵਿੱਚ ਹੀ ਵਿਚਰਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਂ ਤਾਂ ਰਿਆਜ਼ ਜਾਂ ਫਿਰ ਗਾਇਕੀ ਹੀ ਚੱਲਦੀ ਹੈ ਮੈਨੂੰ ਸੰਗੀਤ ਤੋਂ ਬਿਨਾਂ ਹੋਰ ਕੁਝ ਵਧੀਆ ਵੀ ਨਹੀਂ ਲੱਗਦਾ ਅਤੇ ਮੈਂ ਕੋਈ ਹੋਰ ਕੁਛ ਕਰਨਾ ਵੀ ਨਹੀਂ ਚਾਹੁੰਦਾ ਕਿਉਂਕਿ ਨਾ ਤਾਂ ਮੈਨੂੰ ਹੋਰ ਕਿਸੇ ਕੰਮ ਦੀ ਭਾਲ ਹੈ ਅਤੇ ਨਾ ਹੀ ਮੈਂ ਕੁਛ ਕਰਨਾ ਚਾਹੁੰਦਾ ਹਾਂ ਸੰਗੀਤ ਹੀ ਹੈ ਜੋ ਮੇਰਾ ਪੂਰਾ ਜੀਵਨ ਹੈ ਬਸ ਮੈਨੂੰ ਸੰਗੀਤ ਨਾਲ ਹੀ ਲਗਾਅ ਹੈ ਅਤੇ ਮੈਂ ਪੂਰਾ ਦਿਨ ਗਾਉਂਦਾ ਜਾਂ ਤਾਂ ਫਿਰ ਰਿਆਜ ਵਿੱਚ ਹੀ ਬਤੀਤ ਕਰਦਾ ਹਾਂ